ਸਰ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਰੈਸਟੋਰੈਂਟ ਤੋਂ ਆਪਣੇ ਘਰ ਦੀ ਪਾਰਟੀ ਲਈ ਔਡਰ ਮੰਗਵਾਇਆ ਸੀ ਮੈਂ ਕਾਫੀ ਵ ਅ ਕਾਫੀ ਆਈਟਮਾਂ ਔਡਰ ਕੀਤੀਆਂ ਸੀ ਪਰ ਮੈਂ ਹੁਣ ਉਹਨਾਂ ਆਈਟਮਾਂ ਦਾ ਭੁਗਤਾਨ ਗੁੱਗਲ ਪੇ ਕਰ ਰਹੀ ਹਾਂ ਪਰ ਮੈਨੂੰ ਸ਼ੋ ਨਹੀਂ ਹੋ ਰਿਹਾ ਕਿ ਭੁਗਤਾਨ ਹੋਇਆ ਹੈ ਜਾਂ ਨਹੀਂ ਮੈਂ ਕਾਫੀ ਕੋਸ਼ਿਸ਼ ਕਰ ਚੁੱਕੀ ਹਾਂ ਪਰ ਸਾਡੇ ਨੈਟਵਰਕ ਦੀ ਖਰਾਬੀ ਆ ਰਹੀ ਹੈ ਕਿਰਪਾ ਕਰਕੇ ਤੁਸੀਂ ਮੇਰੀ ਨਾ ਥੋੜ੍ਹੀ ਜਿਹੀ ਮਦਦ ਕਰ ਦਿਓ ਮੈਨੂੰ ਚੈੱਕ ਕਰ ਕੇ ਦੱਸੋ ਕਿ ਭੁਗਤਾਨ ਹੋਇਆ ਜਾਂ ਨਹੀਂ ਹੋਇਆ ਜਿਸ ਨਾਲ ਤੁਹਾਨੂੰ ਵੀ ਮੁਸ਼ਕਿਲ ਨਾ ਆਵੇ ਅਤੇ ਮੈਂ ਵੀ ਸ਼ਰਮਿੰਦਾ ਨਾ ਹੋਵਾਂ ਕਿਤੇ ਤੁਸੀਂ ਆਹ ਨਾ ਸੋਚੋ ਕਿ ਮੈਂ ਪੈਸੇ ਨਹੀਂ ਦਿੱਤੇ ਅਤੇ ਤੁਸੀਂ ਮੇਰਾ ਔਡਰ ਵੀ ਕੈਂਸਲ ਕਰ ਦਿਓ ਇਸ ਨਾਲ ਮੈਨੂੰ ਵੀ ਮਤਲਬ ਸ਼ਰਮਿੰਦਗੀ ਮਹਿਸੂਸ ਹੋਊਗੀ ਮੇਰੇ ਘਰ ਦੀ ਪਾਰਟੀ ਵੀ ਖ਼ਰਾਬ ਹੋਊਗੀ ਅਤੇ ਇਸ ਕਰ ਕੇ ਨਾ ਤੁਸੀਂ ਮੈਨੂੰ ਕਲੀਅਰ ਕਰ ਕੇ ਦੱਸੋ ਕਿ ਮੇਰੀ ਪਾਰਟੀ ਵੀ ਖ਼ਰਾਬ ਨਾ ਹੋਵੇ ਤੁਹਾਡੇ ਅੱਗੇ ਵੀ ਮੈਂ ਸ਼ਰਮਿੰਦਾ ਨਾ ਹੋਵਾਂ ਕਿ ਔਡਰ ਹੋ ਮੈਂ ਜਿਹੜਾ ਕੀਤਾ ਸੀ ਉਹਦਾ ਭੁਗਤਾਨ ਹੋਇਆ ਕਿ ਨਹੀਂ ਹੋਇਆ ਮੈਂ ਪਹਿਲਾਂ ਵੀ ਕਾਫੀ ਵਾਰ ਤੁਹਾਡੇ ਕੋਲ ਨਾ ਔਡਰ ਕੀਤੇ ਆ ਟਾਈਮ ਨਾਲ ਉਹਦੀ ਪੇਮੈਂਟ ਵੀ ਕੀਤੀ ਆ ਪਰ ਤੁਸੀਂ ਮੇਰਾ ਨੰਬਰ ਵੀ ਚੈੱਕ ਕਰ ਸਕਦੇ ਤੁਹਾਨੂੰ ਸ਼ਾਇਦ ਦੇਖ ਕੇ ਪਤਾ ਲੱਗ ਗਿਆ ਹੋਣਾ ਤਾਂ ਤੁਸੀਂ ਪਲੀਜ਼ ਮੇਰੀ ਮਦਦ ਕਰੋ ਤੁਸੀਂ ਮੈਨੂੰ ਹਾਲ ਦੱਸ ਦਿਓ ਦੇਖ ਕੇ ਦੱਸੋ ਕਿ ਔਡਰ ਜਿਹੜਾ ਮੈਂ ਕੀਤਾ ਹੈ ਉਹਦਾ ਭੁਗਤਾਨ ਸਫ਼ਲ ਹੋ ਗਿਆ ਹੈ ਜਾਂ ਨਹੀਂ ਹੋ ਗਿਆ ਧੰਨਵਾਦ